ਮੈਂ ਆਪਣੀ ਲਾਈਫ਼ 'ਚ ਬਹੁਤ ਹੀ ਵੱਡੇ ਆਰਟਿਸਟਾਂ ਨੂੰ ਦੇਖਿਆ ਹੋਇਆ ਹੈ ਜਿਹਨਾਂ ਨੂੰ ਮੈਗਜ਼ੀਨਾਂ ਥਰੂ ਅਖ਼ਬਾਰਾਂ ਰਾਹੀਂ ਵੀ ਆਉਂਦੇ ਦੇਖਿਆ ਹੈ ਜਿਹੜੇ ਸਾਡੀ ਇੰਡਸਟਰੀ ਨੂੰ ਬਹੁਤ ਹੀ ਅੱਗੇ ਲੈ ਕੇ ਗਈਆਂ ਹਨ ਲਾਈਕ ਬਾਣੀ ਸੰਧੂ ਸੁਨੰਦਾ ਸ਼ਰਮਾ ਹੋ ਗਈਆਂ ਅਤੇ ਇਹਨਾਂ ਦਾ ਲਾ ਖਾਣਾ ਪਹਿਨਣਾ ਲਾਉਣਾ ਪਾਉਣਾ ਬਹੁਤ ਹੀ ਸਧਾਰਨ ਆ ਜੋ ਕਿ ਸਾਰੀ ਸਾਨੂੰ ਸਾਡੀ ਸਾਰੀ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਹ ਬੜੇ ਹੀ ਸਧਾਰਨ ਤਰੀਕੇ ਨਾਲ਼ ਰਹਿੰਦੀਆਂ ਹਨ ਅਤੇ ਬੜੇ ਸਧਾਰਨ ਤਰੀਕੇ ਨਾਲ਼ ਹੀ ਇੰਡਸਟਰੀ 'ਚ ਕੰਮ ਕਰਦੀਆਂ ਹਨ ਨਹੀਂ ਅੱਜ ਕੱਲ਼੍ਹ ਇੰਡਸਟਰੀ 'ਚ ਕੰਮ ਕਰਨਾ ਕੁੜੀਆਂ ਲਈ ਐਨਾ ਜ਼ਿਆਦਾ ਮੁਸ਼ਕਿਲ ਹੋਇਆ ਹੋਇਆ ਕਿ ਉਹਨਾਂ ਨੂੰ ਪੈਸਾ ਕਮਾਉਣ ਲਈ ਕੁਛ ਵੀ ਕਰਨਾ ਪੈ ਰਿਹਾ ਬਟ ਇਹ ਦੋ ਇਹ ਜਿਹੀਆਂ ਉਹ ਹਨ ਜਿਹਨਾਂ ਨੂੰ ਮੈਂ ਆਪਣੀ ਲਾਈਫ਼ 'ਚ ਦੇਖਿਆ ਬੜੀ ਸਧਾਰਨ ਅਤੇ ਬੜੇ ਹੀ ਡੀਸੈਂਟ ਤਰੀਕੇ ਨਾਲ਼ ਇੰਡਸਟਰੀ ਚੱਲ ਰਹੀਆਂ ਹਨ